ਪੁਰਾਣੇ ਸਮੇਂ ਦੇ ਚਿੱਤਰ ਅਤੇ ਕਲਾਕ੍ਰਿਤੀਆਂ ਨੂੰ ਦੇਖ ਕੇ ਸਾਨੂੰ ਅੱਜ ਵੀ ਪਤਾ ਚੱਲਦਾ ਕਿ ਉਸ ਸਮੇਂ ਸਮੇਂ ਲੋਕਾਂ ਦੀ ਕੀ ਅਹਿਮੀਅਤ ਦੀ ਲੋਕਾਂ ਨੇ ਆਪਣੇ ਹੱਥਾਂ ਨਾਲ ਜੋ ਨਿਕਾਸ਼ੀ ਕੀਤੀ ਹੈ ਉਹਨਾਂ ਦੇ ਨਾਲ ਸਾਨੂੰ ਇਤਿਹਾਸ ਦਾ ਪਤਾ ਚੱਲਦਾ ਪਹਿਲੇ ਟਾਈਮ ਦਾ ਪਤਾ ਚੱਲਦਾ ਕਿ ਲੋਕ ਕਿੱਦਾਂ ਰਹਿੰਦੇ ਸਨ ਕਿਹੜੀਆਂ ਚੀਜ਼ਾਂ ਕਿਵੇਂ ਕੰਮ ਕਰਦੀਆਂ ਸਨ ਪਹਿਲਾਂ ਮਨੁੱਖ ਹੀ ਸੀ ਜੋ ਆਪਣੇ ਹੱਥਾਂ ਨਾਲ ਸਭ ਕੁਝ ਕਰਦਾ ਸੀ ਅਤੇ ਅੱਜ ਦੇ ਟਾਈਮ 'ਤੇ ਵੀ ਜੇ ਅਸੀਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪੜਾਵਾਂਗੇ ਇਹਨਾਂ ਚੀਜ਼ਾਂ ਲਈ ਅਸੀਂ ਉਹਨਾਂ ਨੂੰ ਵਧੀਆ ਸਿੱਖਿਆ ਦਵਾਂਗੇ ਉਹਨੂੰ ਉਹਨਾਂ ਨੂੰ ਅੱਛੇ ਤਰੀਕੇ ਨਾਲ ਆਧੁਨਿਕ ਤਕਨੀਕ ਨਾਲ ਇਹਨਾਂ ਕਲਾ ਅਤੇ ਸ਼ਿਲਪਕਾਰੀ ਦੇ ਵਿੱਚ ਜੇ ਯੋਗਦਾਨ ਦਵਾਂਗੇ ਅਤੇ ਆਉਣ ਵਾਲੀ ਪੀੜੀ ਦੇ ਵਿੱਚ ਵੀ ਇਹ ਸਮਾਜ ਦੇ ਵਿੱਚ ਇੱਕ ਅੱਛਾ ਪ੍ਰਭਾਵ ਪਾਉਣਗੀਆਂ ਲੋਕਾਂ ਨੂੰ ਅੱਜ ਕੱਲ ਦੇ ਜੇ ਅੱਜ ਦੇ ਟਾਈਮ 'ਤੇ ਲੋਕ ਮਨੁੱਖ ਆ ਨਵੀਂ ਪੀੜੀ ਵਾਲੇ ਬੱਚੇ ਜੇ ਆਰਟਸ ਵਾਲੇ ਬੱਚੇ ਜੇ ਕੁਝ ਚੀਜ਼ਾਂ ਇਦਾਂ ਦੀਆਂ ਸਿੱਖਦੇ ਹਨ ਕੁਝ ਅੱਛੀ ਚਿੱਤਰਕਾਰੀ ਸਿੱਖਦੇ ਹਨ ਅਤੇ ਆਪਣੀ ਕਲਾ ਦਾ ਪ੍ਰਸ਼ਨ ਪ੍ਰਦਰਸ਼ਨ ਕਰਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਪਤਾ ਚੱਲੇਗਾ ਕਿ ਸਾਡੇ ਸਮੇਂ ਦਾ ਜਿਹੜਾ ਸੱਭਿਆਚਾਰ ਸੀ ਇਸ ਕਲਚਰ ਸੀ ਉਹਨੂੰ ਲੋਕ ਕਿਵੇਂ ਇਸਤੇਮਾਲ ਕਰਦੇ ਸਨ ਕਿਸ ਤਰੀਕੇ ਨਾਲ ਇੱਥੇ ਚੀਜ਼ਾਂ ਨੂੰ ਕੀਤਾ ਜਾਂਦਾ ਸੀ ਅਤੇ ਇਸ ਨਾਲ ਪੰਜਾਬ ਦੀ ਸੱਭਿਆਚਾਰ ਦਾ ਬਹੁਤ ਪ੍ਰਦਰਸ਼ਨ ਹੋਏਗਾ ਅਤੇ ਪਹਿਲਾਂ ਦੇ ਟਾਈਮ ਦੇ ਗੁਰਦੁਆਰਿਆਂ ਦੇ ਵਿੱਚ ਚਿੱਤਰਕਾਰੀ ਅਤੇ ਸ਼ਿਲਪਕਾਰੀ ਨਾਲ ਬਹੁਤ ਅਲੱਗ ਅਲੱਗ ਆਧੁਨਿਕ ਤਰੀਕੇ ਨਾਲ ਲੋਕਾਂ ਨੇ ਵਿਖਾਣ ਕੀਤਾ ਹੋਇਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਪੁਰਾਣੇ ਭਾਂਡਿਆਂ ਨੂੰ ਦੇਖ ਕੇ ਸਾਨੂੰ ਪਤਾ ਚੱਲਦਾ ਕਿ ਲੋਕ ਕਿਵੇਂ ਉਹਨਾਂ ਬਰਤਨਾਂ ਦਾ ਇਸਤੇਮਾਲ ਕਰਦੇ ਸਨ ਪੁਰਾਣੀ ਚਿੱਤਰ ਚਿੱਤਰਾਂ ਨੂੰ ਦੇਖ ਕੇ ਸਾਨੂੰ ਪਤਾ ਚੱਲਦਾ ਹੈ ਕਿ ਪੁਰਾਣੀਆਂ ਔਰਤਾਂ ਕਿੱਦਾਂ ਆਪਣੇ ਹੱਥ ਨਾਲ ਆਪਣੇ ਹੱਥ ਨਾਲ ਸ਼ਿਲਪਕਾਰੀ ਕਰਦੀਆਂ ਸਨ ਅਤੇ ਚਾਦਰਾਂ 'ਤੇ ਕੜਾਈ ਕਰਦੀਆਂ ਸਨ ਉਹਨਾਂ ਨੂੰ ਦੇਖ ਕੇ ਸਾਨੂੰ ਅੱਜ ਸਮੇਂ ਦਾ ਪਤਾ ਚੱਲਦਾ ਅਤੇ ਜੋ ਕਿ ਬਹੁਤ ਜ਼ਰੂਰੀ ਹੈ ਇਸ ਸਮਾਜ ਦੇ ਵਿੱਚ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਅੱਗੇ ਪਹੁੰਚਾਣ ਲਈ ਧੰਨਵਾਦ